ਵੈਸੇ ਤਾਂ ਚਿੱਤਰਕਾਰੀ ਇੰਨੀ ਵੀ ਆਸਾਨ ਜਾਂ ਇੰਨੀ ਵੀ ਮੁਸ਼ਕਲ ਨਹੀਂ ਹੈ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਉਸ ਚੀਜ਼ ਨੂੰ ਕਿੰਨਾ ਸਮਾਂ ਲਾ ਰਹੇ ਹੋ ਚਿੱਤਰਕਾਰੀ ਕਾਫੀ ਵਧੀਆ ਖੂਬੀ ਹੈ ਜੇ ਤੁਹਾਡੇ ਦੇ ਅੰਦਰ ਇਹ ਪਹਿਲਾਂ ਦੀ ਹੈ ਤਾਂ ਤੁਸੀਂ ਇਸ ਚਿੱਤਰਕਾਰੀ ਬਹੁਤ ਵਧੀਆ ਤਰੀਕੇ ਨਾਲ ਕਰ ਪਾਉਗੇ ਪਰ ਜਿਨ੍ਹਾਂ 'ਚ ਨਹੀਂ ਹੈ ਉਹ ਪਹਿਲੀ ਪਹਿਲੀ ਵਾਰ 'ਚ ਇਹੀ ਗਲਤੀ ਕਰਦੇ ਨੇ ਕਿ ਚਿੱਤਰਕਾਰੀ ਦੇ ਵਿੱਚ ਕਿ ਉਹ ਸਮਾਂ ਜ਼ਿਆਦਾ ਨਹੀਂ ਲਾਉਂਦੇ ਅਭਿਆਸ ਜ਼ਿਆਦਾ ਨਹੀਂ ਕਰਦੇ ਉਹ ਚਾਹੁੰਦੇ ਨੇ ਕਿ ਪਹਿਲੀ ਵਾਰ 'ਚ ਹੀ ਉਹ ਚੀਜ਼ ਬਣ ਕੇ ਆ ਜੇ ਜੋ ਉਹਨਾਂ ਨੇ ਵੇਖੀ ਸੀ ਤਸਵੀਰ ਦੇ ਵਿੱਚ ਇਸ ਲਈ ਚਾਹੀਦਾ ਹੈ ਸਾਰਿਆਂ ਨੂੰ ਕਿ ਚਿੱਤਰਕਾਰੀ ਦਾ ਅਭਿਆਸ ਤੁਹਾਨੂੰ ਬਹੁਤ ਜ਼ਿਆਦਾ ਕਰਨਾ ਪਵੇਗਾ ਫੇਰ ਜਾ ਕੇ ਤੁਸੀਂ ਚੰਗੇ ਤਰੀਕੇ ਨਾਲ ਇੱਕ ਚੰਗੇ ਚਿੱਤਰਕਾਰ ਬਣ ਸਕਦੇ ਹੋ ਜਾਂ ਇੱਕ ਚੰਗੇ ਕਲਾਕਾਰ ਬਣ ਸਕਦੇ ਹੋ ਤੁਹਾਨੂੰ ਸਮਾਂ ਜ਼ਰੂਰ ਲਗਾਉਣਾ ਪਵੇਗਾ ਇੱਕ ਤਸਵੀਰ ਨੂੰ ਬਣਨ 'ਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਕਾਫੀ ਸਾਰੇ ਲੋਕ ਜਲਦਬਾਜ਼ੀ 'ਚ ਇਹ ਗਲਤੀ ਕਰ ਬੈਠਦੇ ਨੇ ਉਹਦਾ ਆਕਾਰ ਗਲਤ ਕਰ ਦੇਣਗੇ ਜਾਂ ਕੋਈ ਲਾਈਨ ਇਸ ਤਰੀਕੇ ਨਾਲ ਮਾਰਨਗੇ ਕਿ ਉਹ ਉਸ ਤਰੀਕੇ ਦੀ ਲੱਗੇਗੀ ਨਹੀਂ ਜਾਣੀ ਕਿ ਤਸਵੀਰ ਉਸ ਤਰੀਕੇ ਦੀ ਲੱਗਦੀ ਨਹੀਂ ਜੋ ਜੋ ਉਹਨਾਂ ਨੇ ਵੇਖੀ ਸੀ ਕੁਝ ਨਾ ਕੁਝ ਗਲਤੀ ਰਹਿ ਜਾਵੇਗੀ ਇਸ ਲਈ ਜੇ ਤੁਸੀਂ ਹੂ ਬ ਹੂ ਤਸਵੀਰ ਬਣਾਉਣਾ ਚਾਹੁੰਦੇ ਹੋ ਜੋ ਤੁਸੀਂ ਵੇਖੀ ਸੀ ਇਸ ਵਿੱਚ ਇਹ ਕੰਮ ਕਰੋ ਕਿ ਤੁਸੀਂ ਉਸ ਫੋਟੋ ਨੂੰ ਚੰਗੇ ਤਰੀਕੇ ਨਾਲ ਟਾਈਮ ਲਗਾਓ ਇੱਕ ਚੰਗੇ ਤਰੀਕੇ ਨਾਲ ਸਮਾਂ ਲਾਉਣ ਵਾਲਾ ਬੰਦਾ ਕਦੇ ਵੀ ਮਾਰ ਨਹੀਂ ਖਾਂਦਾ ਖਾਸਕਰ ਚਿੱਤਰਕਾਰੀ ਦੇ ਵਿੱਚ ਚਿੱਤਰਕਾਰੀ ਦੇ ਵਿੱਚ ਇੱਕ ਸਮਾਂ ਲੱਗਦਾ ਹੈ ਇੱਕ ਚੰਗੀ ਤਰ੍ਹਾਂ ਤਸਵੀਰ ਬਣਾਉਣ ਦੇ ਵਿੱਚ ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਹਮੇਸ਼ਾ ਜਦੋਂ ਵੀ ਚਿੱਤਰਕਾਰੀ ਕਰਨ ਬੈਠੋ ਤਾਂ ਹਮੇਸ਼ਾ ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਾਂ ਲਾ ਕੇ ਬਣਾਓ ਕਾਫੀ ਸਾਰੇ ਨਵੇਂ ਸਿੱਖਣ ਵਾਲੇ ਚਿੱਤਰਕਾਰ ਇਹੀ ਗਲਤੀ ਦੁਹਰਾਉਂਦੇ ਨੇ ਇਸ ਲਈ ਚਾ ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਇੱਕ ਚੰਗੇ ਕਲਾਕਾਰ ਬਣਨ ਲਈ ਇੱਕ ਚੰਗਾ ਸਮਾਂ ਲਾਉਣਾ ਜ਼ਰੂਰੀ ਹੈ ਧੰਨਵਾਦ